ਪੰਜਾਬ ਵਿੱਚ ਵੱਖ ਵੱਖ ਕਿਸਮ ਦੇ ਸਕੂਲ ਹਨ ਜਿਵੇਂ ਕਿ ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਜੇਕਰ ਮੈਂ ਸਰਕਾਰੀ ਸਕੂਲ ਅਤੇ ਉਨ੍ਹਾਂ ਦੇ ਪਾਠਕ੍ਰਮ ਦੀ ਗੱਲ ਕਰਾਂ ਤਾਂ ਇਹ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਦੁਆਰਾ ਨਿਰਧਾਰਿਤ ਕੀਤੇ ਗਏ ਹੁੰਦੇ ਹਨ ਜੋ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਏ ਜਾਂਦੇ ਹਨ ਜਿਸ ਵਿੱਚ ਪੰਜਾਬੀ ਜੋ ਵਿਸ਼ਾ ਹੈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਵਿਸ਼ਾ ਹੁੰਦਾ ਹੈ ਜੋ ਕਿ ਰੱਖਣਾ ਅਤੇ ਇਸ ਨੂੰ ਪੇਪਰਾਂ ਵਿੱਚ ਪਾਸ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜੇਕਰ ਕੋਈ ਵੀ ਬੱਚਾ ਪੰਜਾਬੀ ਵਿੱਚ ਪਾਸ ਨਹੀਂ ਹੋਇਆ ਤਾਂ ਮਤਲਬ ਕਿ ਉਹ ਪੂਰੀ ਕਲਾਸ ਵਿੱਚ ਪਿੱਛੇ ਰਹਿ ਜਾਂਦਾ ਹੈ ਉਹ ਕਲਾਸ ਵਿੱਚ ਹੀ ਫੇਲ੍ਹ ਹੈ ਉਸ ਨੂੰ ਦੁਬਾਰਾ ਆਪਣੀ ਜਮਾਤ ਨੂੰ ਕਰਨਾ ਪੈਂਦਾ ਹੈ ਇਸ ਲਈ ਪੰਜਾਬੀ ਸਭ ਤੋਂ ਜ਼ਰੂਰੀ ਵਿਸ਼ਾ ਬਣਿਆ ਹੋਇਆ ਹੈ ਜੇਕਰ ਮੈਂ ਸਰਕਾਰੀ ਪ੍ਰਾਈਵੇਟ ਸਕੂਲਾਂ ਦੀ ਗੱਲ ਕਰਾਂ ਤਾਂ ਪ੍ਰਾਈਵੇਟ ਸਕੂਲ ਵਿੱਚ ਜੋ ਵਿਸ਼ੇ ਹੁੰਦੇ ਹਨ ਵੋ ਉਹ ਸੀ ਬੀ ਐੱਸ ਈ ਦੁਆਰਾ ਸੈਂਟਰਲ ਬੋਰਡ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ ਇਸ ਲਈ ਇਸ ਵਿੱਚ ਪੰਜਾਬੀ ਬਹੁਤ ਜ਼ਰੂਰੀ ਵਿਸ਼ਾ ਨਹੀਂ ਹੁੰਦਾ ਹੈ ਇਹ ਜ਼ਿਆਦਾਤਰ ਜਿਹੜਾ ਸਾਰਾ ਵਿਸ਼ਾ ਹੁੰਦਾ ਹੈ ਅੰਗਰੇਜ਼ੀ ਉੱਤੇ ਹੀ ਨਿਰਧਾਰਤ ਕੀਤਾ ਜਾਂਦਾ ਹੈ ਇਸ ਵਿੱਚ ਅੰਗਰੇਜ਼ੀ ਅਤੇ ਹਿੰਦੀ ਜ਼ਿਆਦਾ ਕੰਪਲਸਰੀ ਹੁੰਦੇ ਹਨ ਅਤੇ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਸਰਕਾਰੀ ਸਕੂਲਾਂ ਵਿੱਚ ਜੋ ਪੜ੍ਹਾਈ ਹੈ ਉਹ ਜ਼ਿਆਦਾਤਰ ਅਧਿਆਪਕ ਜੋ ਹੁੰਦੇ ਹਨ ਪੜ੍ਹਾਈਆਂ 'ਤੇ ਅਤੇ ਖੇਡਾਂ ਅਤੇ ਜ਼ਿਆਦਾ ਬੱਚਿਆ ਦਾ ਧਿਆਨ ਵਟਾਉਂਦੇ ਹਨ ਪਰ ਸ ਪ੍ਰਾਈਵੇਟ ਸਕੂਲਾਂ ਵਿੱਚ ਇਹ ਸਭ ਤੋਂ ਚੰਗੀ ਗੱਲ ਹੈ ਕਿ ਬੱਚਿਆਂ ਨੂੰ ਹੋਰ ਐਕਸਟਰਾ ਕਲਾਸਿਸ ਵੀ ਦਿੱਤੀਆਂ ਜਾਂਦੀਆਂ ਹਨ ਸਮਾਰਟ ਕਲਾਸਿਸ ਵੀ ਅਰੇਂਜ ਕਰਵਾਈਆਂ ਜਾਂਦੀਆਂ ਹਨ ਜਿਸ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਅੰਦਰ ਦੀਆਂ ਜੋ ਕਲਾਵਾਂ ਹੁੰਦੀਆਂ ਹਨ ਉਨ੍ਹਾਂ ਨੂੰ ਬਾਹਰ ਕਢਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਅੱਗੇ ਜ਼ਿੰਦਗੀ ਵਿੱਚ ਉਹ ਕਿਆ ਕਰ ਸਕਦੇ ਹਨ ਇਸ ਲਈ ਉਨ੍ਹਾਂ ਨੂੰ ਇੱਕ ਦਿਸ਼ਾ ਦਿੱਤੀ ਜਾਂਦੀ ਹੈ